ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਂ ਮੀਡੀਆ ਤੋਂ ਪ੍ਰੀਤ ਗੱਲ ਕਰ ਰਹੀ ਆਂ ਮੈਮ ਮੈਂ ਇਹ ਪੁੱਛਣਾ ਚਾਹੁੰਦੀ ਸੀ ਵੀ ਆਪਣੇ ਮੁਕਤਸਰ ਜਿਲੇ ਤੇ ਸਭ ਤੋਂ ਪ੍ਰਸਿੱਧ ਮੇਲਾ ਕਿਹੜਾ ਲੱਗਦਾ ਜੀ

ਹਾਂਜੀ ਹਾਂਜੀ

ਹਾਂਜੀ ਤੁਸੀਂ ਦੱਸ ਸਕਦੇ ਹੋ ਵੀ ਮੇਲੇ ਵਿੱਚ ਕੀ ਕੁਝ ਹੁੰਦਾ ਵੀ ਕਿਸ ਤਰ੍ਹਾਂ ਦੇ ਪ੍ਰਦਰਸ਼ਨ ਹੁੰਦਾ ਹਾਂਜੀ ਜੀ ਇਹ ਮੇਲਾ ਕਿੰਨੇ ਟਾਈਮ ਪਹਿਲਾਂ ਲੱਗਦਾ ਜੀ ਇਹ ਮੇਲਾ ਕਿੰਨੇ ਟਾਈਮ ਪਹਿਲਾਂ ਲੱਗ ਜਾਂਦਾ ਜੀ ਦਸ ਦਿਨ ਪਹਿਲਾਂ ਜੀ ਅੱਛਾ ਜੀ ਵੀ ਮਤਲਵ ਮੈਂ ਪੁੱਛਣਾ ਚਾਹੁੰਦੀ ਆ ਵੀ ਇਹ ਮੇਰਾ ਕਿਉਂ ਮਨਾਇਆ ਜਾਂਦਾ ਜੀ ਅੱਛਾ ਜੀ ਵੀ ਮੈਂ ਪੁੱਛਣਾ ਚਾਹੁੰਦੀ ਆ ਵੀ ਇਤਿਹਾਸ ਵਿੱਚ ਐਨਾ ਮਹੱਤਵ ਕਿਉਂ ਰੱਖਦਾ ਵੀ ਕਿਹਦੀ ਯਾਦ ਵਿੱਚ ਮਨਾਇਆ ਜਾਂਦਾ ਜੀ ਹਾਂਜੀ ਵੀ ਮਤਲਬ ਇਹ ਮੇਲਾ ਸੰਗਰਾਦ ਨੂੰ ਲੱਗਦਾ ਕਹਿਣ ਦਾ ਮਤਲਬ ਠੀਕ ਐ ਜੀ

ਅੱਛਾ ਜੀ ਵੀ ਮਤਲਬ ਇਹ ਮੇਲਾ ਮੁਕਤਸਰ ਦਾ ਪ੍ਰਸਿੱਧ ਮੇਲਾ ਜੀ ਤੇ ਇਸ ਮੇਲੇ ਚ ਕਿਸ ਤਰ੍ਹਾਂ ਦੇ ਪ੍ਰਸ਼ਨ ਦੇ ਹਾਂਜੀ ਹਾਂਜੀ ਵੀ ਤੁਸੀਂ ਐ ਦੱਸਦੇ ਹੋ ਵੀ ਮੇਲੇ ਚ ਕੀ ਕੁਝ ਹੁੰਦਾ ਹੈਗਾ ਜੀ ਹਾਂਜੀ ਠੀਕ ਹੈ ਜੀ ਠੀਕ ਹ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਜਾਣਕਾਰੀ ਦੇਣ ਲਈ